ਪੰਜਾਬ ਵਿੱਚ ਕਈ ਪ੍ਰਕਾਰ ਦੇ ਤਿਉਹਾਰ ਹੁੰਦੇ ਹਨ ਜਿਵੇਂ ਦਿਵਾਲੀ ਹੋ ਗਈ ਦੁਸਹਿਰਾ ਹੋ ਗਿਆ ਵਿਸਾਖੀ ਦਾ ਮੇਲਾ ਹੋ ਗਿਆ ਅਤੇ ਹੋਰ ਵੀ ਹੋਲੀ ਹੋ ਗਈ ਕਈ ਤਰ੍ਹਾਂ ਦੇ ਤਿਉਹਾਰ ਆਉਂਦੇ ਹਨ ਪਰ ਮੈਂ ਸਿੱਖ ਇਸਲਾਮ ਧਰਮ ਨੂੰ ਮੰਨਣ ਵਾਲਾ ਹਾਂ ਅਸੀਂ ਈਦ ਮਨਾਉਂਦੇ ਹਨ ਅਤੇ ਬਕਰੀਦ ਮਨਾਉਂਦੇ ਹਨ ਇਹਨਾਂ ਵਿੱਚ ਸਾਡਾ ਦੋਹੇ ਤਿਉਹਾਰ ਇਹ ਬਹੁਤ ਮਹੱਤਵਪੂਰਨ ਹੈ ਅਤੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਇਹ ਸਾਲ ਵਿੱਚ ਇੱਕ ਵਾਰ ਹੀ ਆਉਂਦਾ ਹੈ ਈਦ ਇੱਕ ਅਤੇ ਇੱਕ ਬਕਰੀਦ ਅਤੇ ਅਸੀਂ ਈਦ ਵਿੱਚ ਸਵੇਰੇ ਨਹਾਉਂਦੇ ਹਨ ਅਤੇ ਨਵੇਂ ਨਵੇਂ ਕੱਪੜੇ ਪਾਉਂਦੇ ਹਨ ਉਸ ਤੋਂ ਬਾਅਦ ਫਿਰ ਨਮਾਜ਼ ਪੜ੍ਹਦੇ ਹਨ ਅਤੇ ਨਮਾਜ਼ ਦੇ ਬਾਅਦ ਆਪਸ ਵਿੱਚ ਗਲੇ ਲੱਗਦੇ ਲੱਗ ਕੇ ਸਭ ਨੂੰ ਸਲਾਮ ਕਰਦੇ ਹਨ ਉਸ ਤੋਂ ਬਾਅਦ ਆਪਣੇ ਜਿਹੜੇ ਪੜੋਸੀ ਹੈ ਸਾਰਿਆਂ ਨੂੰ ਸੇਵਈਆਂ ਖਿਲਾਉਂਦੇ ਹਨ ਜਿਹੜੇ ਸਾਰੇ ਖੁਸ਼ ਰਹਿੰਦੇ ਅਤੇ ਇਸ ਦਿਨ ਅਸੀਂ ਹਰੇਕ ਬੰਦਿਆਂ ਦੇ ਘਰ ਘਰ ਜਾ ਕੇ ਸੇਵਈਆਂ ਖਾਂਦੇ ਹਨ ਅਤੇ ਜਿਹੜੇ ਸਾਡੇ ਘਰ ਆਉਂਦੇ ਉਹਨਾਂ ਨੂੰ ਵੀ ਅਸੀਂ ਸੇਵੀਆਂ ਖਲਾਂਦੇ